ਮੈਂ ਤੁਹਾਡੇ ਰੈਸਟੋਰੈਂਟ ਸ਼ਿਵ ਸ਼ਕਤੀ ਰੈਸਟੋਰੈਂਟ ਤੋਂ ਭੋਜਨ ਮੰਗਵਾਇਆ ਸੀ ਜਿਸਦੀ ਸੂਚੀ ਇਸ ਪ੍ਰਕਾਰ ਹੈ ਦਾਲ ਮੱਖਣੀ ਦੋ ਪਲੇਟ ਦੋ ਪਲੇਟ ਚਾਵਲ ਇੱਕ ਪਲੇਟ ਮਟਰ ਪਨੀਰ ਛੇ ਰੋਟੀਆਂ ਇੱਕ ਪਲੇਟ ਰਾਜਮਾਂਹ ਨਾਲ਼ ਸਲਾਦ ਅਤੇ ਦੋ ਪਲੇਟ ਗੁਲਾਬ ਜਾਮਨ ਆਡਰ ਕੀਤੇ ਸਨ ਪਰ ਹੁਣ ਤੁਹਾਡਾ ਡਿਲੀਵਰੀ ਬੋਆਏ ਮੈਨੂੰ ਕੈਸ਼ ਔਨ ਡਿਲੀਵਰੀ ਦੀ ਹੀ ਔਪਸ਼ਨ ਦੇ ਰਿਹਾ ਹੈ ਹੋਰ ਕੋਈ ਔਨਲਾਈਨ ਪੇਮੈਂਟ ਦੀ ਔਪਸ਼ਨ ਨਹੀਂ ਦੇ ਰਿਹਾ ਇਸ ਲਈ ਮੈਂ ਇਸ ਔਡਰ ਨੂੰ ਰੱਦ ਕਰਨਾ ਚਾਹੁੰਦਾ ਹਾਂ ਹੁਣ ਤਾਂ ਆਰ ਬੀ ਆਈ ਵੱਲੋਂ ਡਿਜੀਟਲ ਰੂਪੀ ਦੀ ਪ੍ਰਯੋਗ ਵਰਤੋਂ ਪ੍ਰਯੋਗ ਵਜੋਂ ਵਰਤੋਂ ਕੀਤੀ ਜਾ ਰਹੀ ਹੈ ਇਸ ਲਈ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਵੀ ਭੁਗਤਾਨ ਵਜੋਂ ਆਪਣੇ ਗ੍ਰਾਹਕਾਂ ਨੂੰ ਸਾਰੇ ਵਿਕਲਪ ਮੁਹੱਈਆ ਕਰਵਾਓ ਇਸ ਲਈ ਮੈਂ ਤੁਹਾਡੇ ਰੈਸਟੋਰੈਂਟ ਤੋਂ ਆਪਣਾ ਭੋਜਨ ਦਾ ਔਡਰ ਰੱਦ ਕਰਦਾ ਹਾਂ